ਅਕਾਸ਼ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਸ ਤਰ੍ਹਾਂ ਕਿ ਸੂਰਜ ਗ੍ਰਹਿਣ ਚੰਦਰਾ ਚੰਦਰਮਾ ਗ੍ਰਹਿਣ ਸੂਰਜ ਗ੍ਰਹਿਣ ਦਿਨ ਦੇ ਸਮੇਂ ਦੇਖਿਆ ਜਾਂਦਾ ਹੈ ਅਤੇ ਚੰਦਰਮਾ ਗ੍ਰਹਿਣ ਰਾਤ ਦੇ ਸਮੇਂ ਵੇਖਿਆ ਜਾਂਦਾ ਹੈ ਚੰਦਰਮਾ ਗ੍ਰਹਿਣ ਹੋਵੇ ਚਾਹੇ ਸੂਰਜ ਗ੍ਰਹਿਣ ਹੋਵੇ ਅਸੀਂ ਨੰਗੀਆਂ ਅੱਖਾਂ ਨਾਲ਼ ਵੇਖਦੇ ਹਾਂ ਤਾਂ ਉਸ ਨੂੰ ਸਾਡੀਆਂ ਨਿਗ੍ਹਾ 'ਤੇ ਈਫੈਕਟ ਪੈਂਦਾ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੋਈ ਗਰਭ ਅਵਸਥਾ ਵਿੱਚ ਹੋਵੇ ਤਾਂ ਉਸ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਕੱਟਣੀ ਵੱਢਣੀ ਨਹੀਂ ਚਾਹੀਦੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਉਸ ਨੂੰ ਚੱਲਦੇ ਫਿਰਦੇ ਰਹਿਣਾ ਚਾਹੀਦਾ ਹੈ ਲੇਟੇ ਨਹੀਂ ਰਹਿਣਾ ਇਸ ਨਾਲ਼ ਕਈ ਤਰ੍ਹਾਂ ਦੀਆਂ ਸਰੀਰ 'ਤੇ ਈਫੈਕਟ ਪਾਉਂਦੇ ਨੇ ਇਸ ਤਰ੍ਹਾਂ ਇਸ ਤੋਂ ਇਲਾਵਾ ਸੂਰਜ ਗ੍ਰਹਿਣ ਵਿੱਚ ਵੀ ਕਈ ਚੀਜ਼ਾਂ ਹਨ ਜਿਹੜੀਆਂ ਆਪਾਂ ਕਈ ਤਰ੍ਹਾਂ ਦੇ ਲੋਕ ਕਰਦੇ ਨੇ ਉਪਾਅ ਕਰਦੇ ਨੇ ਜਿਸ ਤਰ੍ਹਾਂ ਕਿ ਗ੍ਰਹਿਣ ਲੱਗਣਾ ਹੋਵੇ ਥੋੜ੍ਹੀ ਜਿਹੀ ਕਣਕ ਚੋਲ ਕੁੱ ਖਾਣ ਪੀਣ ਵਾਲੀ ਚੀਜ਼ ਅਲੱਗ ਰੱਖੋ ਉਸ ਤੋਂ ਇਲਾਵਾ ਖਾਣ ਵਾਲੇ ਪਕਵਾਨਾਂ ਵਿੱਚ ਤੁਲਸੀ ਦੇ ਪੱਤੇ ਰੱਖੋ ਫਿਰ ਹੀ ਤੁਸੀਂ ਖਾ ਸਕਦੇ ਹੋ ਕਈ ਤਰ੍ਹਾਂ ਦੀਆਂ ਮਾਨਤਾਵਾਂ ਮੰਨੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਹੀ ਗ੍ਰਹਿਣ ਚੱਲਦੇ ਰਹਿੰਦੇ ਨੇ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਸੂਰਜ ਅਤੇ ਚੰਦਰਮਾ ਦੇ ਗ੍ਰਹਿਣ ਦੇਖੇ ਹਨ